ਮੈਂ ਆਪਣੇ ਫ਼ੋਨ ਵਿੱਚ ਜ਼ਿਆਦਾਤਰ ਵਟਸਐਪ ਫੇਸਬੁੱਕ ਇੰਸਟਾਗ੍ਰਾਮ ਅਤੇ ਆਈਗ੍ਰੰਥ ਧਾਰਮਿਕ ਗ੍ਰੰਥ ਇਹ ਲੋ ਲੋਡ ਕੀਤੇ ਹੋਏ ਆ ਅਤੇ ਜਿਹੜਾ ਆਈਗ੍ਰੰਥ ਹੈ ਜਦੋਂ ਵੀ ਸਾਨੂੰ ਧਾਰਮਿਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਈ ਵੀ ਸ਼ਬਦ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਅਸੀਂ ਆਈਗ੍ਰੰਥ ਨੂੰ ਖੋਲ੍ਹ ਕੇ ਉਹਨੂੰ ਦੇਖਦੇ ਹਾਂ ਅਤੇ ਜਿਹੜਾ ਫੇਸਬੁੱਕ ਹੈ ਉਹ ਤੋਂ ਸਾਨੂੰ ਰੋ ਡੇਲੀ ਜਿਹੜੀ ਜਾਣਕਾਰੀ ਰੋਜ਼ ਦੀ ਜਾਣਕਾਰੀ ਮਿਲਦੀ ਹੈ ਕਿ ਅੱਜ ਕੀ ਹੋਇਆ ਕਿੱਥੇ ਕੀ ਹੋਇਆ ਉਹਦੇ 'ਤੇ ਨਿਊਜ਼ ਵੀ ਆਉਂਦੀਆਂ ਐਪ ਜਿਹੜੇ ਵਟਸਐਪ ਆ ਉਹ 'ਤੇ ਸਾਨੂੰ ਆਪਣੇ ਭੈਣ ਭਰਾਵਾਂ ਦੀਆਂ ਫੋਟੋਆਂ ਵੀ ਆਉਂਦੀਆਂ ਅਸੀਂ ਕੌਲ ਵੀ ਕਰਦੇ ਹਾਂ ਅਤੇ ਉਹਦੇ ਨਾਲ ਸਾਨੂੰ ਕਾਫੀ ਸਹੀ ਲੱਗਦਾ